ਜੋ ਪਹਿਲੀ ਵਾਰ ਭੰਗੜਾ ਪਾਉਣ ਲਈ ਐਰੋਬਿਕਸ ਕਰਨ ਵਿੱਚ ਦਿਲਚਸਪੀ ਰੱਖਦਾ ਮੈਂ ਉਸਨੂੰ ਇਹ ਸਲਾਹ ਦੇਵਾਂਗੀ ਕਿ ਪਹਿਲੀ ਵਾਰ ਭੰਗੜਾ ਐਰੋਵਿਕਸ ਸਿੱਖਣ ਜਾ ਰਹੇ ਹਾਂ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਇਹ ਸਿਰਫ ਇੱਕ ਐਕਸਰਸਾਈਜ਼ ਵਾਂਗ ਹੀ ਹੈ ਸਗੋਂ ਮਜੇਦਾਰ ਤਰੀਕੇ ਨਾਲ ਆਪਣੇ ਆਪ ਨੂੰ ਫਿਟ ਰੱਖਣ ਦਾ ਵਧੀਆ ਜ਼ਰੀਆ ਹੈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਖੁੱਲਾ ਰੱਖ ਕਿਸੇ ਵੀ ਨਵੇਂ ਪਾਸੇ ਲਈ ਤਿਆਰ ਰਹਿ ਸ਼ੁਰੂਆਤ ਵਿੱਚ ਛੋਟੀਆਂ ਛੋਟੀਆਂ ਗਲਤੀਆਂ ਹੋ ਸਕਦੀਆਂ ਨੇ ਪਰ ਹੌਲੀ ਹੌਲੀ ਤੂੰ ਠੀਕ ਹੋ ਜਾਵੇਗਾ ਭੰਗੜੇ ਦੀ ਬੇਸਿਕ ਗੱਲ ਇਹ ਹੈ ਕਿ ਤੂੰ ਆਪਣੀ ਐਨਰਜੀ ਨੂੰ ਫਰੀ ਰੱਖ ਆਪਣੇ ਹੱਥ ਪੈਰ ਅਤੇ ਸਰੀਰ ਨੂੰ ਖੁੱਲ੍ਹਾ ਛੱਡ ਦੇ ਹਰ ਇੱਕ ਬੀਟ 'ਤੇ ਚੁਸਤ ਰਹਿ ਜਦ ਤੂੰ ਮਿਊਜਿਕ ਨਾਲ ਜੁੜੇਗਾ ਤਾਂ ਆਪਣੇ ਆਪ ਹੀ ਰਿਧਮ ਫੜ ਲਵੇਂਗਾ ਜ਼ਰੂਰੀ ਨਹੀਂ ਕਿ ਤੂੰ ਪਹਿਲੇ ਦਿਨ ਹੀ ਪਰਫੈਕਟ ਹੋ ਜਾਵੇਂ ਪਰ ਜਿਵੇਂ ਜਿਵੇਂ ਤੂੰ ਦਿਲੋਂ ਕਰੇਂਗਾ ਤਿਵੇਂ ਤਿਵੇਂ ਤੈਨੂੰ ਮਜ਼ਾ ਆਉਣ ਲੱਗ ਜਾਵੇਗਾ ਕੱਪੜੇ ਹਮੇਸ਼ਾ ਤੂੰ ਆਰਾਮਦਾਇਕ ਪਾ ਜਿਹਨਾਂ ਵਿੱਚ ਤੈਨੂੰ ਹਲਚਲ ਕਰਨ ਵਿੱਚ ਨੱਚਣ ਟੱਪਣ ਵਿੱਚ ਆਸਾਨੀ ਹੋ ਜਾਵੇ ਸ਼ੁਰੂ 'ਚ ਹੌਲੀ ਹੌਲੀ ਕਰ ਬਹੁਤ ਤੇਜ਼ ਨਾ ਦੋੜ ਨਹੀਂ ਤਾਂ ਥਕਾਵਟ ਹੋ ਸਕਦੀ ਹੈ ਪਾਣੀ ਪੀਣਾ ਨਾ ਭੁੱਲੀਂ ਭੰਗੜਾ ਐਰੋਬਿਕਸ ਬਹੁਤ ਐਨਰਜੀ ਲੱਗਦੀ ਹੈ ਤਾਂ ਹਮੇਸ਼ਾ ਹਾਈਡਰੇਟਡ ਰਹਿਣਾ ਚਾਹੀਦਾ ਹੈ ਤੈਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸ਼ਰਮ ਨਾ ਕਰੀਂ ਜਿਵੇਂ ਤੂੰ ਆਪਣੀ ਧੁਨ ਵਿੱਚ ਡੁੱਬੇਂਗਾ ਤੂੰ ਆਪਣੇ ਆਪ ਆਤਮ ਵਿਸ਼ਵਾਸ ਵਧੇਗਾ ਇੱਕ ਵਿਆਮ ਵਾਂਗ ਹੀ ਹੈ ਸਗੋਂ ਤਰੀਕਾ ਹੈ ਆਪਣੇ ਜ਼ਿੰਦਗੀ ਵਿੱਚ ਨਵੀਂ ਤਾਜ਼ਗੀ ਲਿਆਉਣ ਦਾ ਬੁਰੀਆਂ ਗੱਲਾਂ ਭੁੱਲ ਜਾ ਭੰਗੜੇ ਵਾਲੀ ਭੁੱਲ ਜਾ ਭੰਗੜਾ ਇੱਕ ਵਧੀਆ ਹੈ ਜੋ ਸਰੀਰ ਨੂੰ ਫਿਟ ਰੱਖਦਾ ਹੈ